ਮੈਨੂੰ ਚਿੱਤਰਕਾਰੀ ਕਰਨ ਦਾ ਸ਼ੁਰੂ ਤੋਂ ਹੀ ਸ਼ੌਂਕ ਰਿਹਾ ਹੈ ਮੈਂ ਬਹੁਤ ਹੀ ਸੋਹਣੀ ਚਿੱਤਰਕਾਰੀ ਕਰਦੀ ਹਾਂ ਮੇਰੀ ਚਿੱਤਰਕਾਰੀ ਇੱਕ ਵਾਰ ਸਕੂਲ ਦੁਆਰਾ ਅਖ਼ਬਾਰ ਵਿੱਚ ਵੀ ਛਪਾਈ ਗਈ ਸੀਗੀ ਉਸ ਦਿਨ ਸਕੂਲ ਵਿੱਚ ਮਦਰਸ ਡੇ ਸੀ ਜੋ ਕਿ ਸੈਲੀਬਰੇਟ ਕੀਤਾ ਗਿਆ ਸੀ ਮਨਾਇਆ ਗਿਆ ਸੀਗਾ ਅਤੇ ਮੇਰੇ ਪੇਂਟਿੰਗ ਦਾ ਵਿਸ਼ਾ ਓਵੀਅਸਲੀ ਮਾਂ ਸੀਗਾ ਮੈਂ ਉਹ ਇੱਕ ਪਿਕਚਰ ਜਿਹੜੀ ਉਹ ਪੇਂਟਿੰਗ ਨੂੰ ਮੈਂ ਇੱਦਾਂ ਦਰਸਾਇਆ ਸੀ ਕਿ ਮਾਂ ਦੇ ਸੱਤ ਹੱਥ ਵਿਖਾਏ ਸੀਗੇ ਜਿਹਦੇ ਵਿੱਚ ਇੱਕ ਸੋ ਦਾ ਹਾਕੀ ਬੈਟ ਸੀ ਬੋਕਸਿੰਗ ਗਲਬਸ ਸੀਗਾ ਇੱਕ ਕੜਛੀ ਸੀ ਪੈਨ ਸੀਗਾ ਫਿਰ ਆਫਿਸ ਦਾ ਉਹਦਾ ਬੈਗ ਸੀਗਾ ਕਿ ਮਤਲਬ ਇਹ ਚੀਜ਼ ਕਿ ਮਾਂ ਵਾ ਜਿਹੜੀ ਉਹ ਹਰ ਚੀਜ਼ ਕਰਦੀ ਆ ਆਪਣੇ ਲਈ ਆਪਣਾ ਧਿਆਨ ਰੱਖਦੀ ਆ ਆਪਣਾ ਆਫਿਸ ਦਾ ਵੀ ਕੰਮ ਕਰਦੇ ਆ ਆਪਣਾ ਕਰੀਅਰ ਦੇਖਦੇ ਆ ਉਹਦੇ ਨਾਲ ਨਾਲ ਆਪਣੀ ਘਰ ਦੀਆਂ ਜਿੰਮੇਵਾਰੀਆਂ ਨਿਭਾਉਂਦੇ ਆ ਆਪਣੇ ਫੈਮਿਲੀ ਦੇ ਪ੍ਰਤੀ ਵੀ ਜੋ ਵੀ ਉਹਨਾਂ ਦੇ ਰਿਸਪੋਂਸੀਬਿਲਟੀਸ ਆ ਜਿੱਦਾਂ ਉਹਨਾਂ ਨੇ ਮਦਰਇਨਲਾਅ ਜਾਂ ਫਾਦਰਇਨਲਾਅ ਲਈ ਜੋ ਵੀ ਅਗਰ ਕਿਸੇ ਨੇ ਮੈਡੀਸਨ ਆ ਤਾਂ ਉਹ ਟਾਈਮ 'ਤੇ ਦੇਣੀ ਆ ਉਹਨਾਂ ਨੂੰ ਖਾਣਾ ਟਾਈਮ 'ਤੇ ਦੇਣਾ ਯੂਜਲੀ ਬੁੱਢੇ ਲੋਕਾਂ ਨੂੰ ਸ਼ੂਗਰ ਵਗੈਰਾ ਦੀ ਪ੍ਰੋਬਲਮ ਹੁੰਦੀ ਆ ਸੋ ਉਹ ਸਭ ਕੁਝ ਕਿ ਹਾਂ ਉਹਨਾਂ ਦੀ ਸ਼ੂਗਰ ਦੀ ਮੈਡੀਸਨ ਟਾਈਮ 'ਤੇ ਖਾਣੇ 'ਚ ਕਿੰਨਾ ਤਿੱਖਾ ਰੱਖਣਾ ਹੈ ਕਿੰਨਾ ਨਹੀਂ ਉਹ ਸਭ ਕੁਛ ਸੋ ਇਹ ਚੀਜ਼ ਕਿ ਜਿੱਦਾਂ ਕਿਸੇ ਦੇ ਘਰ ਲਕਸ਼ਮੀ ਜਿੱਦਾਂ ਕਿਸੇ ਦੇ ਘਰ ਇੱਕ ਬੇਟੀ ਪੈਦਾ ਹੁੰਦੀ ਹੈ ਤਾਂ ਲੋਕ ਕਹਿੰਦੇ ਕਿ ਲਕਸ਼ਮੀ ਪੈਦਾ ਹੋਈ ਆ ਔਰਤ ਨੂੰ ਅੰਨਪੂਰਨਾ ਵੀ ਕਿਹਾ ਜਾਂਦਾ ਆ ਸੋ ਇਹ ਹੀ ਚੀਜ਼ ਕੀ ਜਿਹੜੀ ਇੱਕ ਮਾਂ ਵਾ ਉਹ ਆਪਣੇ ਲਈ ਸਭ ਕੁਝ ਕਰਦੀ ਆ ਉਹ ਆਪਣੀ ਆਪਣੀ ਹਰ ਰਿਸਪੋਂਸੀਬਿਲਟੀ ਬਹੁਤ ਅੱਛੀ ਤਰ੍ਹਾਂ ਨਿਭਾਉਂਦੀ ਆ ਚਾਹੇ ਉਹ ਆਫਿਸ ਦਾ ਕੰਮ ਹੋਵੇ ਚਾਹੇ ਉਹ ਘਰ ਦਾ ਹੋਵੇ ਬੱਚਿਆਂ ਦੀ ਈਵਨ ਐਜੂਕੇਸ਼ਨ ਦੇਖਣਾ ਉਹਨਾਂ ਦਾ ਵੇਖਣਾ ਕੀ ਹਾਂ ਉਹਨਾਂ ਨੇ ਆਪਣਾ ਹੋਮਵਰਕ ਕੀਤਾ ਕਿ ਨਹੀਂ ਕੀਤਾ ਸੋ ਇਹ ਹੀ ਚੀਜ਼ ਕਿ ਉਹ ਇਹ ਚੀਜ਼ ਦਿਖਾਈ ਗਈ ਕਿ ਜਿੱਦਾਂ ਆਪਣਾ ਆਪਣੀ ਮ ਮੰਮਾ ਨੂੰ ਮਦਰ ਨੂੰ ਫੋਰ ਗਰੰਟਡ ਲੈ ਲੈਂਦੇ ਹਾਂ ਕਿ ਹਾਂ ਚੱਲ ਹੈ ਹੀ ਆ ਇਟਸ ਓਕੇ ਉਹ ਰਹਿਣਗੇ ਹੀ ਉਹ ਆਪਾਂ ਉਹਨਾਂ 'ਤੇ ਗੁੱਸਾ ਕਰਦੇ ਹਾਂ ਸੋ ਉਹ ਚੀਜ਼ ਆਪਾਂ ਨੂੰ ਨਹੀਂ ਕਰਨੀ ਚਾਹੀਦੀ ਹੈ ਆਪਾਂ ਨੂੰ ਉਹਨਾਂ ਦਾ ਧਿਆਨ ਰੱਖਣਾ ਚਾਹੀਦਾ ਹੈ ਪਿਆਰ ਕਰਨਾ ਚਾਹੀਦਾ ਹੈ ਜਿੰਨੀ ਉਹ ਰਿਸਪੈਕਟ ਡਿਜਰਵ ਕਰਦੇ ਉਹ ਆਪਾਂ ਉਹਨਾਂ ਨੂੰ ਦੇਣੀ ਚਾਹੀਦੀ ਹੈ ਸੋ ਉਹਦੇ ਨਾਲ ਮੈਂ ਇਸ ਇਹ ਹੀ ਇੱਕ ਲਾਈਨ ਲਿਖੀ ਸੀ ਕਿ ਜੋ ਵੀ ਤੁਹਾਡੇ ਕੋਲ ਹੈ ਇਸ ਟਾਈਮ ਉਹਨੂੰ ਤੁਸੀਂ ਫੋਰ ਗਾਰੰਟਡ ਨਾ ਲਓ ਕੀ ਪਤਾ ਉਹ ਕੱਲ੍ਹ ਤੁਹਾਡੇ ਤੋਂ ਨਾ ਰਹੇ ਔਰ ਫਿਰ ਤੁਹਾਨੂੰ ਰਿਗਰੈਟ ਕਰਨਾ ਪਵੇ ਕਿ ਜਦੋਂ ਉਹ ਮੇਰੇ ਕੋਲ ਹੈ ਸੀ ਉਦੋਂ ਮੈਂ ਕਿਉਂ ਉਹ ਚੀਜ਼ ਦੀ ਵੈਲਿਊ ਨਹੀਂ ਕੀਤੀ